ਹੈਲੋ ਨਮਸਕਾਰ ਸਰ ਸਰ ਆਪਣੇ ਕੋਲ ਕਿਹੜੇ ਕਿਹੜੇ ਨਿਊਜ਼ ਪੇਪਰ ਹੈਗੇ ਜੀ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਸਰ ਆ ਜਗ ਜਗਬਾਣੀ ਅਤੇ ਆ ਅਜੀਤ ਅਤੇ ਦ ਟ੍ਰਿਬਿਊਨ ਆਉਂਦੇ ਆਪਣੇ ਕੋਲ ਅੱਛਾ ਜੀ ਸਰ ਸੁਬਾਹ ਮੋਰਨਿੰਗ ਕਿੰਨੇ ਵਜੇ ਆਉਣਾ ਤੁਸੀਂ ਪੇਪਰ ਵੰਡਣ ਠੀਕ ਹੈ ਜੀ ਸਰ ਥੋੜ੍ਹਾ ਜਲਦੀ ਨਹੀਂ ਹੋ ਸਕਦਾ ਵੀ ਅੱਧਾ ਘੰਟਾ ਜਾਂ ਘੰਟਾ ਪਹਿਲਾਂ ਆ ਜਾਉ ਅੱਛਾ ਜੀ ਉਹ ਮੈਂ ਕੰਮ 'ਤੇ ਜਾਣਾ ਹੁੰਦਾ ਤਾਂ ਕਰਕੇ ਸਰ ਤਾਂ ਕਰਕੇ ਥੋੜ੍ਹਾ ਜਿਹਾ ਨਾ ਟੈਮ ਦੀ ਹੈਗੀ ਹੈ ਪਾਬੰਦੀ ਚਲੋ ਕੋਈ ਗੱਲ ਨਹੀਂ ਜੀ ਚਲੋ ਬਾਅਦ 'ਚ ਪੜ੍ਹ ਲਿਆ ਕਰਾਂਗੇ ਆ ਕੇ ਸ਼ਾਮ

ਸਰ ਮੈਂ ਨਾ ਜ਼ਿਆਦਾਤਰ ਜਗਬਾਣੀ ਪੜ੍ਹਦਾ ਹੁੰਦਾ ਜੀ ਉਹ ਆਪਾਂ ਨੂੰ ਮਤਲਬ ਵੇਖ ਲਿਓ ਤੁਸੀਂ ਉਹ ਲੈ ਆਇਆ ਕਰੋ ਅਤੇ ਉਹ ਪੜ੍ਹਿਆ ਕਰਾਂਗੇ ਮੈਂ ਜਗਬਾਣੀ ਜ਼ਿਆਦਾ ਪੜ੍ਹਦਾ ਜੀ ਬਾਕੀ ਨਾ ਉਨ੍ਹਾਂ 'ਚ ਸਾਰੀ ਆ ਜਾਂਦੀ ਜਿਵੇਂ ਉੱਧਰ ਬਠਿੰਡਾ ਏਰੀਆ ਕਵਰ ਹੋ ਗਿਆ ਵੀ ਜਲੰਧਰ ਹੋ ਗਿਆ ਦੂਜੇ ਹੋ ਗਏ ਸਾਰੇ ਮਤਲਬ ਨਿਊਜ਼ ਸਾਰੀ ਆ ਜਾਂਦੀ ਹਾਂਜੀ ਜੀ ਹਾਂਜੀ ਹਾਂ ਪੰਜਾਬ 'ਚ ਆ ਜਾਂਦੀ ਇਹ ਤਾਂ ਕਰਕੇ ਆਪਾਂ ਨੂੰ ਜਗਬਾਣੀ ਚਾਹੀਦਾ ਜੀ ਦੂਜਾ ਚਲੋ ਇੰਗਲਿਸ਼ ਦਾ ਉਹ ਮੈਂ ਮੋਬਾਈਲ ਤੋਂ ਪੜ੍ਹ ਲੈਂਦਾ ਉਹ ਤਾਂ ਕੋਈ ਦਿੱਕਤ ਨਹੀਂ ਭਾਅ ਜੀ ਘਰਦੇ ਵੀ ਪੰਜਾਬੀ ਪੜ੍ਹੇ ਨਾ ਤਾਂ ਕਰਕੇ ਥੋੜ੍ਹਾ ਜਿਹਾ ਉਹ ਵੀ ਵੇਖ ਲੈਂਦੇ ਪੜ੍ਹ ਲੈਂਦੇ ਨਿਊਜ਼ ਅਤੇ ਤਾਂ ਕਰਕੇ ਸਰ ਆਪਾਂ ਨੂੰ ਨਾ ਜਗਬਾਣੀ ਚਾਹੀਦਾ ਸੀਗਾ ਸਰ ਫੇਰ ਪੇਮੈਂਟ ਤੁਸੀਂ ਕਿਵੇਂ ਕਰੋਂਗੇ ਜੀ ਮੰਥਲੀ ਚਾਹੀਦੀ ਹੈ ਕਿਵੇਂ ਹੈ ਵੀਕਲੀ ਚਾਹੀਦੀ ਹੈ ਜੀ ਅੱਛਾ ਜੀ ਹਾਂ ਮੰਥਲੀ ਠੀਕ ਰਹੂ ਮੰਥਲੀ ਕਰ ਦਿਆ ਕਰਾਂਗੇ ਹਾਂ ਹਾਂ ਹਾਂ ਮਹੀਨੇ ਤੋਂ ਕਰ ਦਿਆ ਕਰਾਂਗੇ ਉਹ ਸਹੀ ਹੈ ਸਰ ਕਿੰਨਾ ਚਾਰਜ ਹੈ ਜੀ ਅਖ਼ਬਾਰ ਦਾ ਠੀਕ ਹੈ ਜੀ ਠੀਕ ਹੈ ਪੰਜ ਰੁਪਈਏ ਜੀ ਸਰ ਕੋਈ ਹੋਰ ਲਾਉਣਾ ਹੈ ਕਿ ਉਨ੍ਹਾਂ ਦਾ ਮਤਲਬ ਇਹੀ ਰੇਟ ਹੈ ਕਿ ਅਲੱਗ ਅਲੱਗ ਹੈ ਜੀ ਅੱਛਾ ਜੀ ਇੱਕੋ ਰੇਟ ਹੈ ਸਾਰਿਆਂ ਦਾ ਠੀਕ ਹੈ ਜੀ ਠੀਕ ਠੀਕ ਹੈ ਜੀ ਚਲੋ ਮੈਂ ਲਾਉਂਦਾ ਇੱਕ ਦੋ ਘਰ ਹੋਰ ਹੈਗੇ ਨਾਲ ਮੈਂ ਉਨ੍ਹਾਂ ਨੂੰ ਵੀ ਆਖ ਦੂੰ ਠੀਕ ਹੈ ਜੀ ਹਾਂਜੀ ਹਾਂਜੀ ਹਾਂ ਪੁੱਛ ਲਵਾਂਗੇ ਜੀ ਉਨ੍ਹਾਂ ਨੂੰ ਉਹ ਵੀ ਕਹਿੰਦੇ ਸੀਗੇ ਲਾਉਣਾ ਉਹ ਪਤਾ ਨਹੀਂ ਕਿਹੜਾ ਲਾਉਣਗੇ ਅਜੀਤ ਲਾਉਣਗੇ ਕਿ ਹੋਰ ਲਾਉਣਗੇ ਕੋਈ ਅਤੇ ਨਾਲ ਆਪਾਂ ਤਾਂ ਇਕੱਠੇ ਸਾਰੇ ਹੈਗੇ ਕੋਈ ਇੰਗਲਿਸ਼ ਆਪਣੇ ਕੋਲ ਉਹ ਹੁੰਦਾ ਜੀ ਦ ਟ੍ਰਿਬਿਊਨ ਇੰਗਲਿਸ਼ ਹਾਂਜੀ ਹਾਂਜੀ ਉਹ ਆਪਣੇ ਨਾ ਮੁੰਡਾ ਹੈਗਾ ਉਹ ਪੜ੍ਹਦਾ ਇੰਗਲਿਸ਼ ਅਤੇ ਉਹ ਕਹਿੰਦਾ ਮੈਨੂੰ ਇੰਗਲਿਸ਼ ਅਖ਼ਬਾਰ ਲਵਾ ਕੇ ਦਿਓ ਤਾਂ ਕਰਕੇ ਇੱਕ ਉਹ ਲਾਉਣਾ ਇੰਗਲਿਸ਼ ਵਾਲਾ ਲਾਉਣਾ ਠੀਕ ਹੈ ਜੀ ਸੁਬਾਹ ਫੇਰ ਤੁਸੀਂ ਸਾਢੇ ਕੁ ਅੱਠ ਕਰ ਦੇਵੋਂਗੇ ਟੈਮ ਹਾਂਜੀ ਹਾਂਜੀ ਹਾਂ ਤੁਸੀਂ ਆਂਏਂ ਕਰ ਲਿਓ ਨਾ ਫੇਰ ਪਹਿਲਾਂ ਇੱਧਰ ਵੰਡ ਜਾਇਆ ਕਰੋ ਫੇਰ ਦੂਜੀ ਮਤਲਬ ਪਿੰਡ 'ਚ ਹੋਰ ਪਾਸੇ ਦੇਣਾ ਤੁਸੀਂ ਦੇ ਦਿਓ ਉਹ ਮੈਂ ਨਾ ਥੋੜ੍ਹਾ ਜਿਹਾ ਕੰਮ 'ਤੇ ਜਾਣਾ ਹੁੰਦਾ ਤਾਂ ਕਰਕੇ ਥੋੜ੍ਹਾ ਜਿਹਾ ਨਾ ਹੋ ਜਾਂਦਾ ਵੀ ਚਲੋ ਮਾੜਾ ਜਿਹਾ ਫਰੰਟ ਵੇਖ ਲੈਂਦੇ ਹੈ ਚਲੋ ਥੋੜ੍ਹਾ ਜਿਹਾ ਹੋ ਜਾਂਦਾ ਬਾਕੀ ਚਲੋ ਆ ਕੇ ਪੜ੍ਹ ਲਿਆ

ਹਾਂ ਸਹੀ ਗੱਲ ਹੈ ਜੀ ਹਾਂ ਹਾਂ ਚਲੋ ਕੋਈ ਨਹੀਂ ਥੋੜ੍ਹਾ ਜਿਹਾ ਥੋੜ੍ਹਾ ਜਿਹਾ ਕਰ ਲਿਓ ਬਸ ਮਾੜੀ ਜਿਹੀ ਟੈਮ ਦੀ ਅਡਜਸਟਮੈਂਟ ਥੋੜ੍ਹੀ ਜਿਹੀ ਕਰ ਲਿਓ ਠੀਕ ਕੋਈ ਦਿੱਕਤ ਧੰਨਵਾਦ ਜੀ ਧੰਨਵਾਦ ਮਿਹਰਬਾਨੀ ਠੀਕ